ਹਾਂਜੀ ਸਾਹਿਲ ਮੈਂ ਨਾ ਮੈਂ ਫਾਜ਼ਿਲਕਾ ਆਉਣਾ ਸੀਗਾ ਦੋ ਚਾਰ ਦਿਨ ਰਹਿ ਕੇ ਅਤੇ ਇੱਥੇ ਕੋਈ ਹੋਟਲ ਚੰਗਾ ਕਿਹੜਾ ਕਿਹੜਾ ਹੈ ਅੱਛਾ ਹਾਂ ਹਾਂ ਅਤੇ ਹੋਰ ਹੋਰ ਇਸ ਤੋਂ ਕੋਈ ਇਲਾਵਾ ਅੱਛਾ ਕਿਹੜਾ ਏ

ਸਾਫ਼ ਸਫ਼ਾਈ ਹੋਟਲ ਦੀ ਸਾਫ਼ ਸਫ਼ਾਈ ਠੀਕ ਹੈ ਵਧੀਆ ਰਹਿਣ ਨੂੰ ਅੱਛਾ ਵਿਦ ਵਿਦ ਫੈਮਲੀ ਵੀ ਰਹਿਣ ਹੋਵੇ ਤਾਂ ਕੋਈ ਉਹ ਤਾਂ ਨਹੀਂ ਵੀ ਕੋਈ ਕਿਸੇ ਤਰ੍ਹਾਂ ਦੀ ਰੈਂਟ ਵਗੈਰਾ ਕਿੰਨਾ ਕੁ ਲੈਂਦੇ ਆ ਅੱਛਾ ਤੁਹਾਡੇ ਅੱਛਾ ਅੱਛਾ ਅਤੇ ਹੋਰ ਇੱਥੇ ਕੀ ਚੀਜ਼ ਆ ਦੇਖਣ ਵਾਲੀ ਕੋਈ

ਜੇ ਬਾਰਡਰ ਚੌਂਕੀ ਵੀ ਹੈ ਕਿਹੜੀ ਚੌਕੀ ਇੱਥੇ ਜਿਹੜੀ

ਉਹ ਕਿੰਨੇ ਵਜੇ ਕਿੰਨੇ ਵਜੇ ਸ਼ੁਰੂ ਹੁੰਦੀ ਉੱਥੇ ਅੱਛਾ ਹਾਂ ਹਾਂ

ਜਾਣਾ ਆਉਣ ਦਾ ਸਾਧਨ ਉੱਥੇ ਅੱਛਾ ਅੱਛਾ ਠੀਕ ਹੈ ਹੋਰ

ਹਾਂ ਹਾਂ ਹੋਰ ਇਸ ਤੋਂ ਇਲਾਵਾ ਹੋਰ ਕੋਈ ਇਸ ਤੋਂ ਇਲਾਵਾ ਇੱਥੇ ਦਾ ਕੋਈ ਮੇਨ ਚੀਜ਼ ਕੋਈ

ਅੱਛਾ ਅੱਛਾ

ਚਲੋ ਠੀਕ ਹੈ ਮੈਂ ਦੋ ਚਾਰ ਦਿਨ ਤੱਕ ਨੂੰ ਆਉਣਾ ਅਤੇ ਮੈਂ

ਹਾਂ ਹਾਂ ਹਾਂ ਹਾਂ ਠੀਕ ਹੈ ਹਾਂ ਚਲੋ ਠੀਕ ਹੈ ਜੀ ਮੈਂ ਫਿਰ ਦੱਸਾਂਗਾ ਫਿਰ ਮੈਂ ਆ ਰਿਹਾ ਇੱਕ ਦੋ ਦਿਨ ਤੱਕ ਹਾਂ ਹਾਂ ਠੀਕ ਹੈ ਹਾਂਜੀ ਹਾਂ ਹਾਂ ਹਾਂ ਚਲੋ ਠੀਕ ਹੈ ਠੀਕ ਹੈ ਜੀ ਓਕੇ ਜੀ